ਸਤਿ ਸ਼੍ਰੀ ਅਕਾਲ ਜੀ ਕੁਕਿੰਗ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਸ਼ੌਕ ਸੀ ਅਤੇ ਮੈਂ ਸ਼ੁਰੂ ਤੋਂ ਹੀ ਕੁਕਿੰਗ ਬਹੁਤ ਹੀ ਜ਼ਿਆਦਾ ਕਰਦੀ ਹਾਂ ਮੈਂ ਆਪਣੇ ਵਿਹਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਡਿਸ਼ ਬਣਾਉਂਦੀ ਹੀ ਰਹਿੰਦੀ ਹਾਂ ਜੋ ਕਿ ਮੈਂ ਆਪ ਵੀ ਖਾਂਦੀ ਹਾਂ ਅਤੇ ਦੂਸਰਿਆਂ ਨੂੰ ਵੀ ਖਵਾਉਂਦੀ ਹਾਂ ਮੇਰੇ ਹੱਥ ਦੇ ਬਣੇ ਚੀਜ਼ਾਂ ਅਕਸਰ ਲੋਕਾਂ ਨੂੰ ਬਹੁਤ ਹੀ ਜ਼ਿਆਦੀਆਂ ਪਸੰਦ ਆਉਂਦੀਆਂ ਹਨ ਅਤੇ ਉਹ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਇਕ ਦਿਨ ਇੱਦਾਂ ਹੀ ਵਿਹਲੀ ਬੈਠੀ ਮੈਂ ਸੋਚ ਰਹੀ ਸੀ ਕਿ ਕਿਉਂ ਨਾ ਆਪਣੇ ਹੱਥ ਦਾ ਕੋਈ ਮਸਾਲਾ ਬਣਾਇਆ ਜਾਵੇ ਕਿਉਂਕਿ ਅੱਜ ਕੱਲ੍ਹ ਬਾਜ਼ਾਰੀ ਮਸਾਲੇ ਬਹੁਤ ਹੀ ਮਿਲਾਵਟੀ ਹੁੰਦੇ ਹਨ ਅਤੇ ਉਹ ਪਿਓਰ ਨਹੀਂ ਹੁੰਦੇ ਜਿਨ੍ਹਾਂ ਨੂੰ ਖਾ ਕੇ ਸਾਡੀ ਸਿਹਤ 'ਤੇ ਬਹੁਤ ਹੀ ਜ਼ਿਆਦਾ ਅਸਰ ਪੈਂਦਾ ਹੈ ਇਸ ਕਰਕੇ ਮੈਂ ਸੋਚਿਆ ਕਿ ਮੈਂ ਕੋਈ ਆ ਘਰ ਦਾ ਮਸਾਲਾ ਬਣਾਵਾਂਗੀ ਜਿਹੜਾ ਕਿ ਸ਼ੁੱਧ ਹੋਵੇ ਅਤੇ ਉਸਨੂੰ ਖਾਣ ਤੋਂ ਬਾਅਦ ਸਾਡੀ ਸਿਹਤ 'ਤੇ ਵੀ ਕੋਈ ਗਲਤ ਅਸਰ ਨਾ ਪਵੇ ਉਹ ਮਸਾਲਾ ਮੈਂ ਬਹੁਤ ਹੀ ਸਾਰੇ ਮਸਾਲੇ ਲਿਆ ਕੇ ਉਹਨਾਂ ਨੂੰ ਕੁੱਟ ਕੇ ਉਹਨਾਂ ਨੂੰ ਪੀਸ ਕੇ ਅਤੇ ਫਿਰ ਉਹਨਾਂ ਨੂੰ ਇਕੱਠੇ ਕਰਕੇ ਉਹ ਮਸਾਲਾ ਬਣਾਇਆ ਅਤੇ ਉਹ ਮਸਾਲਾ ਬਹੁਤ ਹੀ ਜ਼ਿਆਦਾ ਸ਼ੁੱਧ ਬਣਿਆ ਸੀ ਹੁਣ ਮੈਂ ਕੁਛ ਵੀ ਬਣਾਉਂਦੀ ਹਾਂ ਅਤੇ ਉਹ ਮਸਾਲੇ ਨੂੰ ਉਸ ਹੀ ਉਸ ਪਕਵਾਨ ਦੇ ਵਿੱਚ ਜ਼ਰੂਰ ਪਾਉਂਦੀ ਹਾਂ ਅਤੇ ਉਸ ਮਸਾਲੇ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਮੇਰੇ ਹੱਥ ਦਾ ਪਕਵਾਨ ਖਾ ਕੇ ਲੋਕ ਵਾਰ ਵਾਰ ਇਹ ਹੀ ਕਹਿੰਦੇ ਹਨ ਕਿ ਅਸੀਂ ਤੇਰੇ ਹੱਥ ਦਾ ਪਕਵਾਨ ਹੀ ਖਾਣਾ ਹੈ ਧੰਨਵਾਦ ਜੀ